ਭੰਗੜੇ ਦੇ ਆਮ ਤੌਰ ਤੇ ਕਈ ਤਰ੍ਹਾਂ ਦੇ ਸਟੈਪ ਹੁੰਦੇ ਹਨ ਜਿਨਾਂ ਨੂੰ ਪੰਜਾਬੀ ਆਪਣੇ ਅਲੱਗ ਅਲੱਗ ਤਰੀਕਿਆਂ ਨਾਲ ਪਾਉਂਦੇ ਹਨ ਭੰਗੜੇ ਦੇ ਕੁਛ ਆਮ ਸਟੈਪ ਜਿਵੇਂ ਲੂੰਡੀ ਧਮਾਲ ਜੁੱਤੀ ਹਾਥੀ ਚਾਰ ਝੂਮਰ ਕਿੱਕਲੀ ਹੱਸ ਇਸ ਸਟੈਪ ਆਮ ਤੌਰ ਤੇ ਹਰ ਇੱਕ ਭੰਗੜਾ ਪ੍ਰੋਗਰਾਮ ਵਿੱਚ ਪਾਏ ਜਾਂਦੇ ਹਨ ਇਸ ਚੈ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਨੂੰ ਦਰਸਾਉਂਦੇ ਹਨ ਕਿਉਂਕਿ ਪੰਜਾਬੀ ਦਾ ਪੰਜਾਬੀਆਂ ਦਾ ਸੁਭਾਅ ਕਾਫੀ ਜਸ਼ਨ ਖੁੱਲਾ ਡੁੱਲਾ ਜਸ਼ਨ ਮਨਾਉਣ ਵਾਲਾ ਹੁੰਦਾ ਹੈ ਇਸ ਤਰਾਂ ਇਹ ਕਾਫੀ ਜੋਰਦਾਰ ਤਰੀਕੇ ਨਾਲ ਆਪਣੀ ਖੁਸ਼ੀ ਮਨਾਉਂਦੇ ਹਨ ਇਸ ਕਰਕੇ ਇਹ ਸਟੈਪ ਵੀ ਕਾਫੀ ਜ਼ੋਰਦਾਰ ਅਤੇ ਸਰੀਰ ਖੋਲ ਕੇ ਨੱਚਣ ਵਾਲੇ ਹਨ ਪੰਜਾਬੀ ਇਹ ਸਟੈਪ ਕਾਫੀ ਜ਼ੋਰ ਨਾਲ ਅਤੇ ਜਸ਼ਨ ਨਾਲ ਪਾਏ ਜਾਂਦੇ ਹਨ ਜੋ ਕਿ ਪੰਜਾਬੀਆਂ ਦਾ ਸੁਭਾਅ ਵੀ ਖੁੱਲਾ ਡੁੱਲਾ ਹੁੰਦਾ ਹੈ ਪੰਜਾਬੀ ਇਹਨਾਂ ਸਟੈਪ ਨੂੰ ਹਰ ਖੁਸ਼ੀ ਦੇ ਮੌਕੇ ਤੇ ਜਾਂ ਆਪਣੇ ਪੂਰੇ ਜੋਸ਼ ਨਾਲ ਪਾਉਂਦੇ ਹਨ ਪੰਜਾਬੀ ਇਹਨਾਂ ਸਟੈਪਾਂ ਨੂੰ ਕਰਦੇ ਸਮੇਂ ਪੂਰਾ ਨੱਚ ਕੁੱਦ ਕੇ ਆਪਣੀ ਖੁਸ਼ੀ ਜਾਹਰ ਕਰਦੇ ਹਨ ਇਨਾ ਸਟੈਪਾਂ ਵਿੱਚ ਪੰਜਾਬੀਆਂ ਦਾ ਜ਼ੋਰਦਾਰ ਜਸ਼ਨ ਵਾਲਾ ਸੁਭਾਅ ਸੱਭਿਆਚਾਰ ਸਪਸ਼ਟ ਦਿਖਦਾ ਹੈ ਭੰਗੜੇ ਭੰਗੜਾ ਪਾਉਣਾ ਪੰਜਾਬੀਆਂ ਨੇ ਆਪਣੀ ਦਿਲੋਂ ਖੁਸ਼ੀ ਕਰਕੇ ਭੰਗੜਾ ਪਾਇਆ ਜਾਂਦਾ ਹੈ